ਇਹ ਇੱਕ ਬਾਈਕਰ ਵਜੋਂ ਜਿਹੜੀਆਂ ਸਾਨੂੰ ਮੇਨ ਚੁਣੌਤੀਆਂ ਸਾਨੂੰ ਅੱਜ ਕੱਲ੍ਹ ਅਸੀਂ ਫੇਸ ਕਰ ਰਹੇ ਹਾਂ ਫਸਟ ਹੈਗੀ ਹੈ ਕਿ ਬੱਚੇ ਜੋ ਚਲਾ ਰਹੇ ਨੇ ਅੱਜ ਕੱਲ੍ਹ ਬਹੁਤ ਗੰਦੀ ਡਰਾਈਵ ਕਰਦੇ ਨੇ ਉਹ ਚਾਹੇ ਬਾਈਕਾਂ ਕਰਨ ਚਾਹੇ ਆਪਣੀ ਕਾਰ ਚਲਾਉਂਦੇ ਪਏ ਨੇ ਕਿਉਂਕਿ ਬੱਚਿਆਂ ਨੂੰ ਇਹ ਲੱਗਦਾ ਕਿ ਜਿੱਦਾਂ ਅਸੀਂ ਬਾਈਕ ਚਲਾਉਣੀ ਨਹੀਂ ਉੜਾਉਣੀ ਹੈ ਅਤੇ ਜਿਸ ਕਰਕੇ ਅੱਜ ਕੱਲ੍ਹ ਕਾਫੀ ਸਾਰੇ ਤੁਸੀਂ ਦੇਖਿਆ ਹੋਣਾ ਬੱਚੇ ਸਟੰਟਬਾਜੀ ਬਹੁਤ ਕਰਦੇ ਨੇ ਅਤੇ ਜਿਹਦੇ ਕਰਕੇ ਅੱਜ ਕੱਲ੍ਹ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਅਤੇ ਬੱਚੇ ਕੀ ਕਰਦੇ ਅੱਜ ਕੱਲ੍ਹ ਨਵੇਂ ਜਿਹੜੇ ਹਾਈਵੇ ਬਣਦੇ ਨੇ ਤੇ ਜਾਂ ਫਿਰ ਉਹ ਦੇਖਦੇ ਕਿ ਵੀਡੀਓ ਦੇਖਦੇ ਨੇ ਯੂਟਿਊਬ ਵਗੈਰਾ ਸੋਸ਼ਲ ਮੀਡੀਆ 'ਤੇ ਉਹ ਦੇਖ ਕੇ ਉਹ ਬੱਚੇ ਉਹ ਸਟੰਟ ਕਾਪੀ ਕਰਦੇ ਨੇ ਬਾਈਕ ਵਗੈਰਾ 'ਤੇ ਜਾਂਦੇ ਨੇ ਸੜਕ 'ਤੇ ਅਤੇ ਉਹ ਆਪਣੀ ਉਹ ਆਪਣੀ ਤਾਂ ਨੁਕਸਾ ਜਾਨ ਨੂੰ ਖ਼ਤਰਾ 'ਚ ਪਾਉਂਦੇ ਹੀ ਪਾਉਂਦੇ ਨੇ ਅਤੇ ਉਹ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ 'ਚ ਪਾਉਂਦੇ ਨੇ ਅਤੇ ਦੂਜੀ ਗੱਲ ਅਗਰ ਆਪਾਂ ਗੱਲ ਕੀਤੀ ਜਾਵੇ ਖ਼ਰਾਬ ਟਰੈਫਿਕ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਲੋਕ ਟਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਜਿਸ ਕਰਕੇ ਬਾਈਕਰ ਨੂੰ ਬਾਈਕ ਚਲਾਉਣ 'ਚ ਬਹੁਤ ਜ਼ਿਆਦਾ ਤੰਗੀ ਹੁੰਦੀ ਹੈ ਕਾਰ ਵਾ ਜਿਹਦਾ ਦਿਲ ਕਰਦਾ ਉੱਧਰ ਮੋੜ ਦਿੰਦਾ ਜਿੱਧਰ ਦਿਲ ਕਰਦਾ ਬਸ ਵਾਲਾ ਆਪਣਾ ਮੋੜ ਦਿੰਦਾ ਅਤੇ ਅੱਜ ਕੱਲ੍ਹ ਇੱਕ ਜੋ ਪੰਜਾਬ ਦੀ ਮੇਨ ਬਾਈਕ ਵਾਲੇ ਨੂੰ ਫੇਸ ਤੋਂ ਫੇਸ ਕਰ ਰਹੇ ਨੇ ਉਹ ਹੈਗੀ ਹੈ ਆਟੋ ਵਾਲੇ ਅੱਜ ਕੱਲ੍ਹ ਆਟੋ ਵਾਲੇ ਕੀ ਹੈ ਕੀ ਉਹ ਬਿਨਾਂ ਦੇਖੇ ਦੇਖਿਆ ਸਵਾਰੀ ਖੜ੍ਹੀ ਕਿ ਇੱਕ ਸਵਾਰੀ ਦੇਖੀ ਨਾਲ ਹੀ ਘੁਮਾ ਦਿੰਦੇ ਨੇ ਬਾਈਕ ਆਪਣਾ ਆਟੋ ਘੁਮਾ ਦਿੰਦੇ ਨੇ ਜਿਸ ਕਰਕੇ ਪਿੱਛੇ ਆ ਰਹੇ ਬਾਈਕ ਵਾਲੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਦੂਜੀ ਗੱਲ ਹੈ ਖ਼ਰਾਬ ਮੌਸਮ ਖ਼ਰਾਬ ਮੌਸਮ ਵੀ ਬਾਈਕਰ ਨੂੰ ਕਾਫੀ ਤੰਗ ਕਰਦਾ ਕਿਉਂਕਿ ਜਿੱਦਾਂ ਕਿ ਇੱਕ ਬਾਈਕਾਰ ਨੇ ਅਗਰ ਇੱਥੋਂ ਪੰਜਾਹ ਕਿਲੋਮੀਟਰ ਜਾਣਾ ਅਤੇ ਜਾਂ ਉਹਨੇ ਕਿਤੇ ਹੋਰ ਘੁੰਮਣ ਜਾਣਾ ਅਗਰ ਰਸਤੇ 'ਚ ਜ਼ਿਆਦਾ ਠੰਡ ਹੋਈ ਉਹ ਤਾਂ ਵੀ ਨਹੀਂ ਚਲਾ ਸਕਦਾ ਧੁੰਦ ਹੋਈ ਤਾਂ ਉਹਨੂੰ ਨਜ਼ਰ ਨਹੀਂ ਆਏਗਾ ਅਤੇ ਅਗਰ ਬਾਰਿਸ਼ ਹੋਈ ਤਾਂ ਉਹ ਵੈਸੇ ਉਹਨੂੰ ਬਾ ਬਾਈਕ ਨਹੀਂ ਚਲਾ ਸਕਦਾ ਕਿਉਂਕਿ ਉਹਨੇ ਆਪ ਗਿੱਲਾ ਹੋ ਜਾਣਾ ਅਤੇ ਜਿਹਦੇ ਕਰਕੇ ਉਹਨੂੰ ਫਿਰ ਅੱਗੇ ਜਾ ਕੇ ਕੋਈ ਨਾ ਕੋਈ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਅਤੇ ਦੂਜੀ ਗੱਲ ਕਿ ਜਿਹੜੀ ਸਾਡੇ ਪੰਜਾਬ ਦੀ ਸੜਕਾਂ ਨੇ ਉਹ ਅੱਜ ਤੋਂ ਕੋਈ ਪੱਚੀ ਸਾਲ ਪਹਿਲਾਂ ਤੀਹ ਸਾਲ ਪਹਿਲਾਂ ਬਣਾਈਆਂ ਗਈਆਂ ਉਸ ਟਾਈਮ ਇੰਨੀ ਟਰੈਫਿਕ ਨਹੀਂ ਸੀਗੀ ਅਤੇ ਜਿਹਦੇ ਕਰਕੇ ਸੜਕਾਂ ਛੋਟੀਆਂ ਹੋ ਗਈਆਂ ਨੇ ਅਤੇ ਟਰੈਫਿਕ ਵੱਧ ਗਿਆ ਜਿਹਦੇ ਕਰਕੇ ਬਾਈਕ ਵਾਲਿਆਂ ਨੂੰ ਕਾਫੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਅਤੇ ਹੁਣ ਬਾਏ ਗੱਲ ਕਰੀਏ ਅਗਰ ਬਾਇਕ 'ਤੇ ਆਪਾਂ ਕਦੀ ਘੁੰਮਣ ਜਾਂਦੇ ਹਾਂ ਉ ਉੱਚੀਆਂ ਜਗ੍ਹਾਵਾਂ 'ਤੇ ਹਿਮਾਚਲ ਵਗੈਰਾ ਉੱਥੇ ਅੱਜ ਕੱਲ੍ਹ ਜਮੀਨ ਬਹੁਤ ਖਿਸਕਦੀ ਪਈ ਹੈ ਅਤੇ ਜਮੀਨ ਖਿਸਕਣ ਜਮੀਨ ਖਿਸਕਣ ਜਮੀਨ ਖਿਸਕਣ ਕਰਕੇ ਵੀ ਉਹ ਬਾਈਕ ਵਾਲੇ ਬਾਈਕ ਵਾਲੇ ਨੂੰ ਬਾਈਕ ਵਾਲਿਆਂ ਨੂੰ ਕਾਫੀ ਜ਼ਿਆਦਾ ਅੱਜ ਕੱਲ੍ਹ ਜਿੱਦਾਂ ਕਿ ਨੁਕਸਾਨ ਹੋ ਰਿਹਾ ਸੱਟਾਂ ਲੱਗ ਰਹੀਆਂ ਵੀ ਜਾਂ ਫਿਰ ਉਹ ਕਈ ਵਾਰ ਤਾਂ ਬਾਈਕ ਵਾਲੇ ਦੀ ਡੈਥ ਵੀ ਜਾਂਦੀ ਹੈ ਅਤੇ ਅਗਰ ਰਾਤ ਨੂੰ ਆਪਾਂ ਬਾਈਕ 'ਤੇ ਟਰੈਵਲ ਕਰਦੇ ਤਾਂ ਜੰਗਲੀ ਜਾਨਵਰ ਅੱਜ ਕੱਲ੍ਹ ਬਹੁਤ ਜ਼ਿਆਦਾ ਬਾਈਕ ਵਾਲਿਆਂ ਨੂੰ ਤੰਗ ਕਰਦੇ ਪਏ ਨੇ ਅਤੇ ਉਸ ਕਰਕੇ ਵੀ ਕਾਫੀ ਜ਼ਿਆਦਾ ਬਾਈਕ ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਅਤੇ ਇਸ ਲਈ ਸਾਨੂੰ ਅਗਰ ਆਪਣੇ ਚੀਜ਼ਾਂ ਤੋਂ ਵਰਤਣਾ ਬਚਣਾ ਚਾਹੁੰਦੇ ਹਾਂ ਤਾਂ ਆਪਣਾ ਖਿਆਲ ਸਾਨੂੰ ਆਪ ਰੱਖਣਾ ਪੈਣਾ ਅਗਰ ਹੋ ਸਕੇ ਅਤੇ ਅਗਰ ਤੁਸੀਂ ਹਿਮਾਚਲ ਟਰੈਵਲ ਕਰ ਰਹੇ ਹੋ ਤਾਂ ਦਿਨ ਦੇ ਟਾਈਮ 'ਤੇ ਟਰੈਵਲ ਕਰੋ ਸੜਕਾਂ ਜ਼ਿਆਦਾ ਖੁੱਲ੍ਹੀਆਂ ਜਿਹੜੇ ਅੱਜ ਕੱਲ੍ਹ ਜਿੱਦਾਂ ਹਾਈਵੇ ਬਣ ਰਹੇ ਨੇ ਉਹਨਾਂ 'ਤੇ ਟਰੈਵਲ ਕਰੋ ਉਹ 'ਤੇ ਇੰਨੀ ਟਰੈਫਿਕ ਨਹੀਂ ਹੁੰਦੀ